ਮੇਰੀ ਜੀ ਇੱਕ ਭੈਣ ਹੈ ਜੋ ਕਿ ਮੇਰੇ ਤੋਂ ਉਮਰ ਵਿੱਚ ਅੱਠ ਸਾਲ ਵੱਡੀ ਹੈ ਸਾਡੀਆਂ ਆਦਤਾਂ ਕੁਝ ਤਾਂ ਮਿਲਦੀਆਂ ਹਨ ਕੁਛ ਨਹੀਂ ਮਿਲਦੀਆਂ ਹਨ ਜਿਵੇਂ ਕਿ ਲੜਾਈ ਨੂੰ ਅਸੀਂ ਇੱਕ ਦੂਜੇ ਨਾਲ ਲੜਨੇ ਨੂੰ ਬਹੁਤ ਤੇਜ਼ ਹਾਂ ਅਤੇ ਦਿਆ ਦੀ ਭਾਵਨਾ 'ਚ ਇੱਕ ਦੂਜੇ ਨਾਲ਼ ਸਾਥੀ ਹਾਂ ਇਸ ਲਈ ਇਹ ਤਾਂ ਕੁਦਰਤੀ ਰੂਪ ਤੋਂ ਰੱਬ ਵੱਲੋਂ ਬਖਸ਼ਿਸ਼ ਹੁੰਦੀ ਹੈ ਕਿ ਜਿਹੜੇ ਇੱਕ ਪੇਟ ਚੋਂ ਜਨਮ ਲੈਂਦੇ ਹਾਂ ਇੱਕ ਢਿੱਡ ਚੋਂ ਜਨਮ ਲੈਂਦੇ ਹਨ ਉਹਨਾਂ ਦੀਆਂ ਕੁਝ ਆਦਤਾਂ ਚੰਗੀਆਂ ਹੁੰਦੀਆਂ ਹਨ ਕੁਝ ਮਾੜੀਆਂ ਹੁੰਦੀਆਂ ਹਨ ਤਾਂ ਸਾਡੀ ਗੱਲ ਕਰੀਏ ਸਾਡਾ ਆਪਣੇ ਭੈਣ ਭਰਾਵਾਂ ਵਿੱਚ ਬਹੁਤ ਚੰਗਾ ਪਿਆਰ ਹੈ ਮੇਰੀ ਵੱਡੀ ਭੈਣ ਹੈ ਮੈਨੂੰ ਕੁੱਟਦੀ ਮਾਰਦੀ ਵੀ ਬਹੁਤ ਹੈ ਅਕਲ ਆਈ ਆ ਉਹਨਾਂ ਤੋਂ ਸਾਨੂੰ ਸਿੱਖ ਕੇ ਕੰਮ ਸਿੱਖ ਕੇ ਹਰ ਕੰਮ ਦੀ ਵੱਡੇ ਭੈਣ ਭਰਾ ਤੋਂ ਹੀ ਸਾਨੂੰ ਅਕਲ ਆਉਂਦੀ ਹੈ ਹਰ ਇੱਕ ਕੰਮ ਦੀ ਸਿੱਖਣਾ ਵੀ ਕਿਵੇਂ ਦੁਨੀਆਦਾਰੀ ਚੱਲਦੀ ਹੈ ਕਿਵੇਂ ਸਾਨੂੰ ਦੇਖ ਰਹੇ ਕਿ ਹਰ ਕੰਮ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ